ਹੈਲੋ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਸਾਡੇ ਪਿੰਡ ਵਿੱਚ ਸਾਰੇ ਹੀ ਪੰਜਾਬੀ ਬੋਲਦੇ ਹਨ ਮੈਂ ਵੀ ਪੰਜਾਬੀ ਬੋਲਦੀ ਹਾਂ ਅਤੇ ਮੇਰਾ ਪੂਰਾ ਪਰਿਵਾਰ ਵੀ ਪੰਜਾਬੀ ਬੋਲਦਾ ਹੈ ਮੈਨੂੰ ਪੰਜਾਬੀ ਬੋਲਣਾ ਬਹੁਤ ਹੀ ਪਸੰਦ ਹੈ ਦਿਲਚਸਪ ਲੱਗਦਾ ਹੈ ਮੇਰੇ ਮੈਂ ਸਕੂਲ ਕੋਲਜ ਵਿੱਚ ਵੀ ਪੰਜਾਬੀ ਮੀਡੀਅਮ ਹੀ ਰੱਖਿਆ ਹੋਇਆ ਸੀ ਪੰਜਾਬੀ ਮੀਡੀਅਮ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਸਾਡੇ ਸਾਰੇ ਹੀ ਪਿੰਡ ਨਿਵਾਸ ਵਾਲੇ ਪੰਜਾਬੀ ਹੀ ਬੋਲਦੇ ਹਨ ਬੋਲਦੇ ਹਨ